ਮੂਰਤੀ ਕਲਾ ਦੇ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ ਹੈ ਅਤੇ ਨਾ ਹੀ ਮੈਂ ਕਦੀ ਇਹ ਬਣਾਈ ਹੈ ਅਤੇ ਮੈਨੂੰ ਲੱਗਦਾ ਵੀ ਨਹੀਂ ਹੈ ਕਿ ਕਦੀ ਮੈਂ ਕਦੀ ਇਸ ਤਰ੍ਹਾਂ ਦੀ ਕੋਈ ਮੂਰਤੀ ਬਣਾਊਂਗਾ ਜਾਂ ਕੁਝ ਕਰਗੁ ਮੇਰਾ ਕੋਈ ਵੀ ਕਿਸੇ ਕਿਸਮ ਦੀ ਦਿਲਚਸਪੀ ਹੈ ਨਹੀਂ ਇਹਦੇ 'ਚ